ਮੈਂ ਬਚਪਨ ਦੇ ਵਿੱਚ ਤਾਰੇ ਦੇਖਦੀ ਹੁੰਦੀ ਸੀ ਉਸ ਟਾਇਮ ਬੜੇ ਸਾਫ਼ ਦਿਖਦੇ ਹੁੰਦੇ ਸੀ ਪਰ ਜੇ ਹੁਣ ਦੀ ਗੱਲ ਕਰੀਏ ਹੁਣ ਪ੍ਰਦੂਸ਼ਣ ਜ਼ਿਆਦਾ ਹੋ ਗਿਆ ਗੱਡੀਆਂ ਕਾਰਾਂ ਇਹ ਬਹੁਤ ਚੱਲਦੀਆਂ ਨੇ ਇਸ ਕਰਕੇ ਸਾਨੂੰ ਧੁੰਦਲਾ ਧੁੰਦਲਾ ਨਜ਼ਰ ਆਉਂਦਾ ਖਾਸਕਰ ਸਾਡੇ ਰੋਪੜ ਸ਼ਹਿਰ ਦੇ ਵਿੱਚ ਅਤੇ ਹੋਰ ਚੀਜ਼ਾਂ ਜਿੱਦਾਂ ਸਾਡੇ ਇਲਾਕੇ ਦੇ ਵਿੱਚ ਨਦੀਆਂ ਨਹਿਰਾਂ ਨੇ ਜ਼ਿਆਦਾ ਇਸ ਰੋਪੜ ਸ਼ਹਿਰ ਨੂੰ ਘੇਰਿਆ ਹੋਇਆ ਹੈ ਅਤੇ ਜਿਹੜਾ ਪ੍ਰਦੂਸ਼ਣ ਹੈ ਇਹ ਬਹੁਤ ਜ਼ਿਆਦਾ ਅਤੇ ਅੱਜ ਦੇ ਟਾਇਮ ਦੀ ਗੱਲ ਕਰੀਏ ਸਾਨੂੰ ਜਿਹੜਾ ਇੱਕ ਅਸਮਾਨ ਹੈ ਤਾਰੇ ਹੈ ਬਹੁਤ ਘੱਟ ਦੇਖਣ ਨੂੰ ਨਜ਼ਰ ਆਉਂਦੇ ਨੇ ਕਿਉਂਕਿ ਇਨ੍ਹਾਂ ਚੀਜ਼ਾਂ ਦਾ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ